ਭਾਰਤੀ ਸੁਤੰਤਰਤਾ ਸਮਾਗਮ ਦੇ ਅਸਲੀ ਕਹਾਣੀ ਉਨੀ ਸੋ ਉਨੀ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਬਾਰਾਂ ਸੀ ਜਦ ਕੇ ਭਾਰਤ ਦੇ ਰਾਜਨੀਤਿਕ ਵਿੱਚ ਮਹੱਤਵ ਮਹਾਤਮਾ ਗਾਂਧੀ ਦਾਖਲ ਹੋਏ ਉਹ ਉਨੀ ਸੋ ਪੰਦਰਾ ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਵਾਪਿਸ ਆਏ ਤਿੰਨ ਵਰਿਆਂ ਤੱਕ ਉਹਨਾਂ ਨੇ ਇਸ ਦੇਸ਼ ਦੇ ਰਾਜਨੀਤਿਕ ਮਾਹੌਲ ਦਾ ਅਧਿਐਨ ਕੀਤਾ ਉਹਨਾਂ ਪਹਿਲੇ ਮਹਾ ਯੁੱਧ ਵਿਚ ਅੰਗਰੇਜ਼ੀ ਸਰਕਾਰ ਨੂੰ ਨੈਤਿਕ ਸਮਰਥਨ ਵੀ ਦਿੱਤਾ ਪਰ ਉਨੀ ਸੋ ਉਨੀ ਵਿੱਚ ਸਾਰੀ ਹਾਲਤ ਬਦਲ ਗਈ ਇਸ ਸੰਕਟ ਸਏ ਸਮੇਂ ਮਹਾਤਮਾ ਗਾਂਧੀ ਸੁਤੰਤਰਤਾ ਸੁਤੰਤਰਤਾ ਸੰਗਰਾਮੀ ਬਣ ਗਿਆ ਬਣ ਕੇ ਸਾਡੇ ਸਾਹਮਣੇ ਆਏ ਤੇ ਉਹਨਾਂ ਨੇ ਸੱਚ ਤੇ ਕਿਸੇ ਨੂੰ ਦੁੱਖ ਨਾ ਦੇਣ ਤੇ ਜੋਰ ਅਤੇ ਅੰਗਰੇਜ਼ੀ ਸਾਮਰਾਜ ਦੀਆਂ ਜੜਾਂ ਖੋਖਲੀਆਆਂ ਕਰ ਦਿੱਤੀਆਂ ਉਨੀ ਸੋ ਉਨੀ ਤੋਂ ਉਨੀ ਸੋ ਬਾਈ ਤੱਕ ਮਹਾਤਮਾ ਗਾਂਧੀ ਜੀ ਬਹੁਤ ਕੰਮ ਕਰਦੇ ਸਨ ਉਸ ਸਮੇਂ ਦੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹਨ ਪਹਿਲੇ ਮਹਾਤਮਾ ਦੇ ਮਹਾਂਯੁੱਧ ਦੇ ਖਤਮ ਹੋਣ ਤੇ ਭਾਰਤ ਨੇ ਕੁਝ ਕਰਨ ਲਈ ਮਾਊਂਟਨ ਇਸ ਦੀ ਰਿਪੋਰਟ ਸ਼ਿਕਾਇਤ ਕੀ ਦਿੱਤੀ ਤੇ ਭਾਰਤ ਦੀਆਂ ਨੇ ਯੁੱਧ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ ਉਹਨਾਂ ਨੂੰ ਵਿਸ਼ਵਾਸ ਵੀ ਸੀ ਕਿ ਯੁੱਧ ਵਿੱਚ ਜਿੱਤਣ ਵਾਂਗੂ ਸਰਕਾਰ ਉਹਨਾਂ ਨੂੰ ਜਿਆਦਾ ਅਧਿਕਾਰ ਦੇਵੇਗੀ ਪਰ ਇਹ ਰਿਪੋਰਟ ਨਾਲ ਭਾਰਤੀ ਲੋਕ ਨਿਰਾਸ਼ ਹੋ ਗਏ ਸਰਕਾਰਾਂ ਨੂੰ ਸਰਕਾਰ ਵੀ ਡਰ ਗਈ ਸੀ ਕਿ ਜਰੂਰ ਕੋਈ ਨਵਾਂ ਅੰਦੋਲਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਹਾਲਤ ਨੂੰ ਕਾਬੂ ਕਾਬੂ ਵਿੱਚ ਕਰਨ ਲਈ ਸਰਕਾਰ ਨੂੰ ਰੋਲ ਐਕਟ ਪਾਸ ਕੀਤਾ ਨਾ ਮਿਲਵਰਤਨਾ ਅੰਦੋਲਨ ਇਨਾ ਦਿਨ ਹੀ ਮੁਸਲਮਾਨਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਖਿਲਾਫਤ ਅੰਦੋਲਨ ਛੇੜਿਆ ਹੋਇਆ ਸੀ ਜਨਤਾ ਪਹਿਲਾਂ ਵੀ ਭੜਕੀ ਹੋਈ ਸੀ ਮਹਾਤਮਾ ਗਾਂਧੀ ਜੀ ਨੇ ਇਸ ਮੌਕੇ ਦਾ ਲਾਭ ਉਠਾਇਆ ਤੇ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰ ਦਿੱਤਾ ਇਸ ਤਰ੍ਹਾ ਹਿੰਦੂਆਂ ਨੇ ਮੁਸਲਮਾਨਾਂ ਨੇ ਮਿਲ ਕੇ ਅੰਗਰੇਜ਼ੀ ਸਰਕਾਰ ਵਿੱਚ ਵਿਰੋਧਤਾ ਕੀਤੀ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਕਾਲਜਾ ਵਿੱਚ ਬਾਈਕਾਟ ਕਰ ਦਿੱਤਾ ਵਕੀਲਾਂ ਨੇ ਅਦਾਲਤਾਂ ਵਿੱਚ ਜਾਣਾ ਬੰਦ ਕਰ ਦਿੱਤਾ ਕਈ ਲੋਕਾਂ ਨੇ ਅੰਗਰੇਜ਼ੀ ਸਰਕਾਰ ਦੁਆਰਾ ਦਿੱਤੀ ਗਈ ਪਦਵੀਆਂ ਤਿਆਗ ਦਿੱਤੀਆਂ ਲੋਕਾਂ ਨੂੰ ਅੰਗਰੇਜ਼ੀ ਕੱਪੜਿਆਂ ਦਾ ਬਾਈਕਾਟ ਕੀਤਾ ਤੇ ਹੱਥ ਦਾ ਬਣਿਆ ਕੱਪੜਾ ਪਾਉਣਾ ਸ਼ੁਰੂ ਕਰ ਦਿੱਤਾ ਗਾਂਧੀ ਜੀ ਨੇ ਸੰਤੁਲਨ ਉਹ ਸ਼ਾਂਤ ਖਤਮ ਢੰਗ ਨਾਲ ਚਲਾਉਣਾ ਚਾਹੁੰਦੇ ਸਨ ਪਰ ਉਨੀ ਸੋ ਬਾਈ ਈਸਵੀ ਵਿੱਚ ਉੱਤਰ ਪ੍ਰਦੇਸ਼ ਦੇ ਕਿਸੇ ਇੱਕ ਪਿੰਡ ਚੋਰੀ ਚਰਾ ਵਿੱਚ ਇੱਕ ਪੁਲਿਸ ਚੌਂਕੀ ਨੇ ਸਿਪਾਹੀਆਂ ਸਮੇਤ ਸਾੜ ਦਿੱਤਾ ਗਿਆ